ਹੈਲੋ ਤੁਸੀਂ ਓਲਾ ਕੰਪਨੀ ਤੋਂ ਬੋਲ ਰਹੇ ਜੇ ਅਸੀਂ ਨਾ ਤੁਹਾਡੀ ਕੰਪਨੀ ਤੋਂ ਇੱਕ ਕੈਬ ਬੁੱਕ ਕਰਵਾਈ ਸੀ ਅਸੀਂ ਆਪਣੇ ਪਿੰਡ ਤੋਂ ਜੇ ਹਿਮਾਚਲ ਵੱਲ ਜਾਣਾ ਸੀ ਅਤੇ ਇਸ ਕਰਕੇ ਤੁਹਾਡੀ ਕੈਬ ਤਾਂ ਟਾਈਮ ਸਿਰ ਪਹੁੰਚ ਗਈ ਹੈ ਸਾਡੇ ਕੋਲ ਪਰ ਜਦੋਂ ਅਸੀਂ ਵੇਖਿਆ ਤਾਂ ਜਿਹੜੀ ਤੁਹਾਡੀ ਕੈਬ ਦੇ ਵਿੱਚ ਡਰਾਇਵਰ ਸੀ ਉਹਨੇ ਮਾਸਕ ਨਹੀਂ ਪਾਇਆ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਕਰੋਨਾ ਦਾ ਟਾਈਮ ਚੱਲ ਰਿਹਾ ਇਹ ਬਹੁਤ ਖਤਰਨਾਕ ਟਾਈਮ ਆ ਅਤੇ ਇਹਦੇ ਵਿੱਚ ਮਾਸਕ ਪਾਉਣਾ ਸਾਰਿਆਂ ਲਈ ਜ਼ਰੂਰੀ ਆ ਪਰ ਜਿਵੇਂ ਡਰਾਇਵਰ ਦੇ ਮਾਸਕ ਨਾ ਪਾਉਣ 'ਤੇ ਬਿਮਾਰੀ ਹੋਰ ਫੈਲ ਸਕਦੀ ਆ ਅਸੀਂ ਨਾਲ਼ ਜਾਣਾ ਅਤੇ ਬਿਮਾਰੀ ਸਾਨੂੰ ਵੀ ਲੱਗ ਸਕਦੀ ਆ ਅਤੇ ਜਦੋਂ ਅਸੀਂ ਕੈਬ ਦੇ ਅੰਦਰ ਵੇਖਿਆ ਤਾਂ ਸੀਟਾਂ ਵੀ ਸਾਰੀਆਂ ਫਟੀਆਂ ਹੋਈਆਂ ਸੀ ਉਹਦੇ ਵਿੱਚ ਗੰਦਗੀ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਤੁਹਾਡੀ ਟਰਾਂਸਪੋਰਟ ਏਜੰਸੀ ਨੂੰ ਸ਼ਿਕਾਇਤ ਕਰਦੀ ਹਾਂ ਕਿ ਅੱਗੇ ਤੋਂ ਸਾਨੂੰ ਇਹ ਸ਼ਿਕਾਇਤ ਦਾ ਮੌਕਾ ਨਾ ਦਿੱਤਾ ਜਾਵੇ ਅਤੇ ਜਿਹੜੀ ਆ ਕੈਬ ਦੀ ਸਫਾਈ ਵੀ ਹੋਵੇ ਅਤੇ ਡਰਾਇਵਰ ਜਿਹੜਾ ਵਾ ਉਹ ਮਾਸਕ ਵੀ ਪਾ ਕੇ ਆਵੇ ਅਤੇ ਇਸ ਕਰਕੇ ਮੈਂ ਬੇਨਤੀ ਕਰਦੀ ਹਾਂ ਕਿ ਜਿਹੜਾ ਕੈਬ ਦਾ ਡਰਾਇਵਰ ਆ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਅਤੇ ਅੱਗੇ ਤੋਂ ਕੋਈ ਵੀ ਗਲਤੀ ਨਾ ਹੋਵੇ